ਪੰਜਾਬੀ ਲੋਕ ਗੀਤਾਂ ਦਾ ਘੇਰਾ ਬਹੁਤ ਹੀ ਜ਼ਿਆਦਾ ਵਿਸ਼ਾਲ ਘੇਰਾ ਹੈ ਪੰਜਾਬੀ ਲੋਕ ਗੀਤਾਂ ਦੇ ਵਿੱਚੋਂ ਪੰਜਾਬੀ ਸੱਭਿਆਚਾਰ ਦੀ ਤਸਵੀਰ ਝਲਕਦੀ ਹੈ ਇੱਕ ਅਜਿਹੀ ਤਸਵੀਰ ਜਿਸਦੇ ਵਿੱਚ ਸੁਹਾਗ ਘੋੜੀਆਂ ਜੋ ਕਿ ਵਿਆਹ ਦੇ ਵੇਲੇ ਗਾਏ ਜਾਂਦੇ ਹਨ ਟੱਪੇ ਮਾਹੀਏ ਬੋਲੀਆਂ ਅਤੇ ਲੋਰੀਆਂ ਜੋ ਕਿ ਮਾਂ ਇੱਕ ਬੱਚੇ ਨੂੰ ਉਸਦੇ ਸੌਣ ਦੇ ਟੈਮ 'ਤੇ ਸੁਣਾਉਂਦੀ ਹੈ ਅਲਾਹਣੀਆਂ ਕੀਰਨੇ ਵੈਣ ਜਦੋਂ ਕੋਈ ਮਰਦਾ ਹੈ ਤਾਂ ਉਸ ਵੇਲੇ ਇਹ ਅਲਾਹਣੀਆਂ ਕੀਰਨੇ ਅਤੇ ਵੈਣ ਪਾਏ ਜਾਂਦੇ ਹਨ ਹੋਰ ਵੀ ਕਈ ਤਰ੍ਹਾਂ ਦੇ ਲੋਕ ਗੀਤ ਹੁੰਦੇ ਨੇ ਕੁਝ ਲੋਕ ਗੀਤ ਜਿਵੇਂ ਕਿ ਕੰਨਾਂ ਨੂੰ ਸੋਹਣੇ ਬੂੰਦੇ ਪੰਜ ਭਰਾ ਸੋਹਣਿਆਂ ਮਹਿਲਾਂ ਦੇ ਪਿਛਵਾੜੇ ਲੱਠੇ ਦੀ ਚਾਦਰ ਚੰਨ ਦੀ ਰਾਤ ਸੜਕੇ ਸੜਕੇ ਕਈ ਤਰ੍ਹਾਂ ਦੇ ਲੋਕ ਗੀਤ ਹੁੰਦੇ ਹਨ ਜੋ ਕਿ ਅਲੱਗ ਅਲੱਗ ਵੇਲੇ ਪਾਏ ਜਾਂਦੇ ਹਨ ਜਦੋਂ ਮੁੰਡਾ ਜੰਮਦਾ ਹੈ ਤਾਂ ਉਸ ਵੇਲੇ ਕੁਝ ਹੋਰ ਹੀ ਤਰ੍ਹਾਂ ਦੇ ਲੋਕ ਗੀਤ ਹੁੰਦੇ ਹਨ ਜਦੋਂ ਕੁੜੀ ਜਾਂ ਮੁੰਡੇ ਦਾ ਵਿਆਹ ਹੁੰਦਾ ਆ ਮਾਹੀਆ ਹੁੰਦਾ ਨੂੰ ਲੱਗਦਾ ਤਾਂ ਉਦੋਂ ਅਲੱਗ ਅਲੱਗ ਤਰ੍ਹਾਂ ਦੇ ਜਿਹੜੇ ਲੋਕ ਗੀਤ ਨੇ ਉਹ ਗਾਏ ਜਾਂਦੇ ਨੇ ਇਹਨਾਂ ਲੋਕ ਗੀਤਾਂ ਨੂੰ ਇੱਕ ਸ਼ਬਦ ਦੇ ਵਿੱਚ ਬਿਆਨ ਕਰ ਪਾਉਣਾ ਬਹੁਤ ਹੀ ਮੁਸ਼ਕਲ ਹੈ ਜਿੰਨਾ ਹੀ ਬੋਲੋ ਲੋਕ ਗੀਤਾਂ ਬਾਰੇ ਬਹੁਤ ਘੱਟ ਹੈ ਕਿਉਂਕਿ ਇਸ ਦਾ ਘੇਰਾ ਬਹੁਤ ਹੀ ਜ਼ਿਆਦਾ ਵਿਸ਼ਾਲ ਹੈ